ਮੈਂ ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਹੀ ਕੰਮ ਸ਼ੁਰੂ ਕਰਤਾ ਸੀ ਕਿਉਂਕਿ ਸਾਡੇ ਘਰ ਦੀ ਵਿਵਸਥਾ ਕੁਝ ਠੀਕ ਨਹੀਂ ਸੀ ਜਦੋਂ ਮੈਂ ਬਾਰਵੀਂ ਪਾਸ ਕੀਤੀ ਤਾਂ ਮੈਨੂੰ ਘਰਦਿਆਂ ਵੱਲੋਂ ਵੀ ਕਿਹਾ ਗਿਆ ਅਤੇ ਮੈਂ ਆਪ ਵੀ ਸੋਚਿਆ ਕਿ ਮੈਨੂੰ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਕਿ ਮੈਂ ਆਪਣੇ ਘਰਦਿਆਂ ਦੀ ਮਦਦ ਕਰ ਸਕਾਂ ਮੈਂ ਬਾਰਵੀਂ ਤੋਂ ਬਾਅਦ ਟਿਊਸ਼ਨ ਸੈਂਟਰ ਆਪਣਾ ਖੋਲ੍ਹਿਆ ਛੋਟਾ ਜਿਹਾ ਅਤੇ ਉਥੋਂ ਹੀ ਆਪਣਾ ਅਰਨ ਕਰਨਾ ਚਾਲੂ ਕਰਤਾ ਟੀਚਰ ਲਾਈਨ ਦੇ ਵਿੱਚ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਇੰਟਰਸਟ ਸੀ ਅਤੇ ਮੈਂ ਇਸ ਫੀਲਡ ਦੇ ਵਿੱਚ ਹੀ ਅੱਗੇ ਵਧੀ ਅਤੇ ਟਿਊਸ਼ਨ ਸੈਂਟਰ ਤੋਂ ਆਪਣਾ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਇਸ ਨੂੰ ਹੋਰ ਵੱਡੇ ਪੱਧਰ 'ਤੇ ਲੈ ਕੇ ਜਾਵਾਂ ਅਤੇ ਇਸ ਤੋਂ ਅੱਗੇ ਵੀ ਹੋਰ ਟੀਚਰ ਨੂੰ ਬੁਲਾਵਾਂ ਤਾਂ ਕਿ ਉਹ ਇਸ ਤੋਂ ਵੱਡਾ ਹੋਰ ਇੰਸਟੀਟਿਊਸ਼ਨ ਖੋਲ੍ਹ ਸਕਣ ਅਤੇ ਇਸ ਇੰਸਟੀਟਿਊਸ਼ਨ ਨੂੰ ਖੋਲ੍ਹਣ ਵਾਸਤੇ ਮੈਨੂੰ ਬੈਂਕ ਦੀ ਮਦਦ ਦੀ ਲੋੜ ਪਵੇਗੀ ਕਿਉਂਕਿ ਇਸ ਨੂੰ ਖੋਲ੍ਹਣ ਵਾਸਤੇ ਮੈਨੂੰ ਲੋਨ ਚਾਹੀਦਾ ਹੋਵੇਗਾ ਅੱਜ ਕੱਲ੍ਹ ਲੋਨ ਬਹੁਤ ਘੱਟ ਇੰਟਰਸਟ ਰੇਟ 'ਤੇ ਮਿਲਦਾ ਪਿਆ ਹੈ ਅਤੇ ਮੈਂ ਬੈਂਕ ਤੋਂ ਮਦਦ ਲਵਾਂਗੀ ਤਾਂ ਕਿ ਉਹ ਮੈਨੂੰ ਲੋਨ ਦੇਵੇ ਅਤੇ ਮੈਂ ਇਸ ਤੋਂ ਆਪਣਾ ਕਾਰੋਬਾਰ ਖੋਲ੍ਹ ਸਕਾਂ ਅਤੇ ਆਪਣੇ ਇੰਸਟੀਟਿਊਟ ਨੂੰ ਹੋਰ ਵਧੀਆ ਲੈਵਲ 'ਤੇ ਲੈ ਕੇ ਜਾ ਸਕਾਂ ਅਤੇ ਬੱਚਿਆਂ ਨੂੰ ਪੜ੍ਹਾ ਸਕਾਂ